ਪੰਜਾਬ ਵਿੱਚ ਕਲਾ ਅਤੇ ਸ਼ਿਲਪ ਖੇਤਰ ਰਾਜ ਵਿੱਚ ਹਰ ਸੈਕਟਰਾਂ ਜਾਂ ਉਦਯੋਗਾਂ ਵਿੱਚ ਪਰਸਪਰ ਪ੍ਰਭਾਵ ਪਾਉਂਦਾ ਹੈ ਜਿਵੇਂ ਕਿ ਫੈਸ਼ਨ ਡਿਜ਼ਾਇਨਿੰਗ ਫੈਸ਼ਨ ਡਿਜ਼ਾਇਨਿੰਗ ਵਿੱਚ ਅਗਰ ਇੱਕ ਕਲਾ ਦਾ ਦੇਖਿਆ ਜਾਵੇ ਤਾਂ ਹੈਂਡ ਪ੍ਰਿੰਟਿੰਗ ਬਹੁਤ ਜ਼ਿਆਦਾ ਪ੍ਰਚਲਿਤ ਹੈ ਹੈਂਡ ਬਲੋਕਿੰਗ ਹੈਂਡ ਪ੍ਰਿੰਟਿੰਗ ਇਹ ਅੱਜ ਕੱਲ੍ਹ ਬਹੁਤ ਜ਼ਿਆਦਾ ਫੇਮਸ ਹੈ ਕਿਵੇਂ ਡਿਜ਼ਾਈਨ ਬਣਾਉਣਾ ਏ ਇਹ ਪਹਿਲੇ ਇੱਕ ਗ੍ਰਾਫ ਕੀਤਾ ਜਾਂਦਾ ਜੋ ਇੱਕ ਆਰਟਿਸਟ ਵਲੋਂ ਕੀਤਾ ਜਾਂਦਾ ਹੈ ਪਹਿਲੇ ਇਹ ਗ੍ਰਾਫਿੰਗ ਪੈਨਸਿਲ ਨਾਲ ਹੁੰਦੀ ਹੈ ਓਹ ਤੋਂ ਬਾਅਦ ਇਹਨੂੰ ਕੰਪਿਊਟਰਾਇਸ ਕਰ ਕੇ ਇਹਨੂੰ ਅਸੀਂ ਅੱਗੇ ਫੈਕਟਰੀਆਂ ਵਿੱਚ ਭੇਜਦੇ ਹਾਂ ਇਸ਼ਤਿਹਾਰ ਵੀ ਤਾਂ ਹੀ ਬਣਾਏ ਜਾਂਦੇ ਹਨ ਜਾਂ ਕਿਸੇ ਫਿਲਮਾਂ ਦਾ ਹੈਗਾ ਹੈ ਅਗਰ ਕੋਈ ਅਸੀਂ ਕਿਸੇ ਚੀਜ਼ ਨੂੰ ਡੇਕੋਡ ਕਰਨਾ ਹੈਗਾ ਉਹਦੇ ਵਾਸਤੇ ਪਹਿਲੇ ਇੱਕ ਹੈਂਡ ਪ੍ਰਿੰਟ ਬਣਾਇਆ ਜਾਂਦਾ ਹੈ ਹੈਂਡ ਪ੍ਰਿੰਟ ਤੋਂ ਬਾਅਦ ਉਸ ਨੂੰ ਅੰਜਾਮ ਦਿੱਤਾ ਜਾਂਦਾ ਏ ਕਿ ਉਹ ਅੱਗੇ ਕਿਵੇਂ ਬਣੇਗਾ